ਭੰਗੜੇ ਦੇ ਆਮ ਸਟੈਪ ਝੂਮਰ ਲੁੱਡੀ ਸੰਮੀ ਹਨ ਅਤੇ ਜਿੱਥੇ ਜ਼ੋਰਦਾਰ ਜਸ਼ਨ ਵਾਲੇ ਸੁਭਾਅ ਵਿੱਚ ਭੰਗੜਾ ਬਹੁਤ ਹੀ ਯੋਗਦਾਨ ਪਾਉਂਦਾ ਹੈ ਭੰਗੜਾ ਇੱਕ ਪੂਰੀ ਊਰਜਾ ਨਾਲ ਕੀਤਾ ਜਾਣ ਵਾਲਾ ਲੋਕ ਨਾਚ ਹੈ ਜਿਸ ਨਾਲ ਲੋਕਾਂ ਵਿੱਚ ਪੂਰੀ ਊਰਜਾ ਆ ਜਾਂਦੀ ਹੈ ਅਤੇ ਲੋਕ ਬੜੀ ਖੁਸ਼ੀ ਨਾਲ ਭੰਗੜਾ ਕਰਦੇ ਹਨ